ਹਾਂਜੀ ਦੀਦੀ ਕੌਣ ਬੋਲ ਰਹੇ ਹੋ ਹਾਂਜੀ ਦੀਦੀ ਮੈਂ ਨਾ ਨੌਕਰੀ 'ਤੇ ਲੱਗਣਾ ਮੈਂ ਨੌਕਰੀ ਬਾਰੇ ਤੁਹਾਨੂੰ ਪੁੱਛਣਾ ਹੈਗਾ ਜੀ ਹਾਂਜੀ ਵੀ ਮੈਂ ਨੌਕਰੀ 'ਤੇ ਲੱਗਣਾ ਹੈਗਾ ਵੀ ਮੈਂ ਕਿੱਥੇ ਲੱਗਾਂ ਜੀ ਨੌਕਰੀ 'ਤੇ ਕਿਹੜੀ ਥਾਂ ਵੀ ਅੱਛਾ ਜੀ ਅੱਛਾ ਜੀ ਵੀ ਕਿਵੇਂ ਜਿਵੇਂ ਫੀਸ ਫੂਸ ਕਿਵੇਂ ਹੈ ਵੀ ਉੱਥੇ ਮਹਿੰਗੀ ਤਾਂ ਨਹੀਂ ਹੈਗੀ ਫੀ ਅੱਛਾ ਜੀ ਐਂ ਵੀ ਪਹਿਲਾਂ ਵੀ ਸੂਟ ਵੀ ਵਧੀਆ ਉੱਥੇ ਉਹ ਨੇ ਵੀ ਲੱਗੇ ਹੋਏ ਨੇ ਜੀ

ਅੱਛਾ ਜੀ ਮੈਨੂੰ ਐਂ ਹੀ ਸੀ ਜੀ ਵੀ ਮੈਂ ਹਾਂ ਵਧੀਆ ਹੋਣ ਵੀ ਜਿੱਥੇ ਮੈਂ ਨੌਕਰੀ ਕਰਾਂ ਇੱਥੋਂ ਨਾ ਨੌਕਰੀ ਮਿਲਣੀ ਹੈਗੀ ਜੀ ਅੱਛਾ ਜੀ ਠੀਕ ਦੀਦੀ ਤੁਸੀਂ ਵੀ ਉੱਥੇ ਜੌਬ ਕਰਦੇ ਹੋ ਜੀ ਅੱਛਾ ਜੀ

ਠੀਕ ਹੈ ਦੀਦੀ ਅਤੇ ਕਿੰਨੇ ਕੁ ਵਜੇ ਕਦੋਂ ਆਵਾਂ ਜੀ ਸਵੇਰੇ ਤਾਂ ਸੰਡੇ ਹੈ ਜੀ ਅੱਛਾ ਜੀ ਊਂ ਸਾਰੇ ਵਧੀਆ ਸੁਭਾਅ ਸਾਰਿਆਂ ਦਾ ਵੀ ਉੱਥੇ ਵੀ ਕੋਈ ਚਿੜ੍ਹਦੇ ਜਿਹੇ ਤਾਂ ਨਹੀਂ ਹੈਗੇ ਇੱਕ ਦੂਸਰੇ ਤੋਂ ਵੀ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਦੀ ਫੀਸ ਘੱਟ ਹੋਵੇ ਕਿਉਂ ਹੁਣ ਬਹੁਤ ਜ਼ਿਆਦਾ ਵਾ ਹੋਰ ਜ਼ਿਆਦਾ ਭਰਾਉਂਦੇ ਨੇ ਜ਼ਿਆਦਾ ਜੀ ਅੱਛਾ ਜੀ ਬਸ ਐਂ ਹੀ ਚਾਹੀਦਾ ਸੀ ਵੀ ਬਸ ਵਧੀਆ ਪੜ੍ਹਾਉਣ ਹੈ ਨਾ ਵਧੀਆ ਜੌਬ ਚਲ ਮਿਲ ਜਾਵੇ ਵੀ ਘੱਟ ਤੋਂ ਘੱਟ ਹੈ ਨਾ ਅੱਛਾ ਜੀ ਜੀ ਸਮਾਨ ਤਾਂ ਨਹੀਂ ਤੁਹਾਨੂੰ ਅੱਛਾ ਜੀ ਅੱਛਾ ਜੀ ਅਤੇ ਤੁਸੀਂ ਵੀ ਉਹ ਉਹ ਅੱਛਾ ਜੀ ਠੀਕ ਹੈ ਜੀ ਹਾਂਜੀ ਚਲੋ ਆਏਂ ਆਏਂ ਨਹੀਂ ਪਤਾ ਹੋਰ ਆਏਂ ਨਹੀਂ ਪਤਾ ਹੋਰ ਵੀ ਬੁਢਲਾਡੇ ਦੀਆਂ ਉੱਥੋਂ ਹੋਰ ਜੋ ਜੋਬ 'ਤੇ ਲੱਗੀ ਹੋਣ ਹਾਂਜੀ ਕੋਈ ਨਾ ਜੀ ਸਵੇਰੇ ਮੈਂ ਆਪ ਆਉਂਗੀ ਠੀਕ ਹੈ ਜੀ ਓਕੇ ਧੰਨਵਾਦ ਜੀ ਥੈਂਕ ਯੂ